ਆਪਣੇ ਇਤਿਹਾਸ ਦੌਰਾਨ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਾਂ ਵਿੱਚ ਬਹੁਤ ਸਾਰੀ ਤਬਦੀਲੀ ਆਈ ਹੈ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਵੈਸਟਰਨ ਭਾਸ਼ਾ ਦੀ ਜਦੋਂ ਕਿ ਵੈਸਟਰਨ ਲੋਕ ਸਾਡੇ ਪੰਜਾਬ ਵਿੱਚ ਜਾਂ ਸਾਡੇ ਦੇਸ਼ ਵਿੱਚ ਦਾਖਲ ਹੋਏ ਤਾਂ ਉਸ ਨਾਲ ਸਾਡੀ ਮਾਂ ਬੋਲੀ ਜੋ ਕਿ ਜਿਸ ਰਾਹੀਂ ਅਸੀਂ ਜੰਮੇ ਪਲੇ ਸਿੱਖੀ ਹੈ ਉਹ ਉਸ ਨੂੰ ਪ੍ਰਭਾਵਿਤ ਬਹੁਤ ਜ਼ਿਆਦਾ ਕੀਤਾ ਹੁਣ ਜੇ ਆਪਾਂ ਐਗਜਾਮਪਲ ਦੇ ਤੌਰ 'ਤੇ ਦੇਖੀਏ ਤਾਂ ਅੱਜ ਕੱਲ੍ਹ ਦੇ ਬੱਚਿਆਂ ਦੀ ਪੰਜਾਬੀ ਭਾਸ਼ਾ ਦੇ ਵਿੱਚ ਇੰਗਲਿਸ਼ ਦੇ ਸ਼ਬਦ ਐਂਟਰ ਹੋ ਚੁੱਕੇ ਨੇ ਜਿਵੇਂ ਕਿ ਹੁਣ ਮੈਂ ਵੀ ਬੋਲਿਆ ਕਿ ਇੰਗਲਿਸ਼ ਦੇ ਸ਼ਬਦ ਐਂਟਰ ਹੋ ਚੁੱਕੇ ਨੇ ਮਤਲਬ ਸਾਡੀ ਮਾਂ ਬੋਲੀ ਦੇ ਵਿੱਚ ਇੰਗਲਿਸ਼ ਰਚ ਚੁੱਕੀ ਹੈ ਇਸੇ ਤਰ੍ਹਾਂ ਹੀ ਇਤਿਹਾਸ ਦੌਰਾਨ ਪੰਜਾਬੀ ਭਾਸ਼ਾ 'ਚ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਜੋ ਕਿ ਸਾਡੀ ਭਾਸ਼ਾ ਦੇ ਵਿੱਚ ਐਂਟਰ ਹੋ ਚੁੱਕੀਆਂ ਨੇ ਇਸੇ ਤਰ੍ਹਾਂ ਹੀ ਸਾਡਾ ਸੱਭਿਆਚਾਰ ਵੀ ਬਹੁਤ ਪ੍ਰਭਾਵਿਤ ਹੋਇਆ ਜਿਸ ਤਰ੍ਹਾਂ ਕਿ ਸਾਡੇ ਕੱਪੜੇ ਪਹਿਰਾਵੇ ਦੀ ਗੱਲ ਕਰੀਏ ਸਾਡਾ ਪਹਿਰਾਵਾ ਜੋ ਕਿ ਪੰਜਾਬੀ ਦਾ ਪਹਿਲਾਂ ਸਿੰਪਲ ਕੁੜਤਾ ਚਾਦਰਾ ਹੁੰਦਾ ਸੀ ਜੋ ਕਿ ਹੁਣ ਜੀਨਾਂ ਅਤੇ ਟੌਪਾਂ ਵਿੱਚ ਬਦਲ ਚੁੱਕਿਆ ਹੈ ਪਹਿਲਾਂ ਅਸੀਂ ਜੁੱਤੀਆਂ ਚੱਪਲਾਂ ਪਾਉਂਦੇ ਹੁੰਦੇ ਸੀ ਪਰ ਹੁਣ ਅੱਜ ਕੱਲ੍ਹ ਦੇ ਜੇ ਆਪਾਂ ਨੌਜਵਾਨ ਮੁੰਡਿਆਂ ਦੀ ਕੁੜੀਆਂ ਦੀ ਇੱਥੋਂ ਤੱਕ ਕਿ ਬਜ਼ੁਰਗਾਂ ਦੀ ਵੀ ਗੱਲ ਕਰੀਏ ਜੋ ਕਿ ਬੂਟਾਂ ਅਤੇ ਬੂਟਸ ਦੇ ਵਿੱਚ ਬਦਲ ਚੁੱਕੇ ਨੇ ਜੋ ਕਿ ਇੱਕ ਪੂਰੀ ਤਰ੍ਹਾਂ ਸਾਡੇ ਸੱਭਿਆਚਾਰ ਵਿੱਚ ਬਦਲਾਅ ਆਇਆ ਹੈ ਪਹਿਲਾਂ ਅਸੀਂ ਸਿੰਪਲ ਭਾਸ਼ਾ ਸਿੰਪਲ ਖਾਣਾ ਅਤੇ ਸਿੰਪਲ ਪਹਿਰਾਵੇ 'ਚ ਵਿਸ਼ਵਾਸ ਕਰਦੇ ਸੀ ਪਰ ਵੈਸਟਰਨ ਦੇ ਐਂਟਰ ਹੋਣ ਨਾਲ ਸਾਡੀ ਭਾਸ਼ਾ ਸਾਡੇ ਪਹਿਰਾਵੇ ਅਤੇ ਸਾਡੇ ਖਾਣ ਪੀਣ ਵਿੱਚ ਬਹੁਤ ਹੀ ਜ਼ਿਆਦਾ ਤਬਦੀਲੀ ਆਈ ਹੈ ਜਿਸ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇਤਿਹਾਸ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਅਤੇ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸਾਰੀ ਤਬਦੀਲੀ ਆਈ ਹੈ